ਸਤਿ ਸ਼੍ਰੀ ਅਕਾਲ ਮੇਰਾ ਗੈਸ ਸਲਿੰਡਰ ਦਾ ਕਨੈਕਸ਼ਨ ਤੁਹਾਡੀ ਕੰਪਨੀ ਵਿੱਚ ਹੈਗਾ ਹੈ ਮੈਂ ਆਪਣੀ ਰਿਹਾਇਸ਼ ਚੇਂਜ ਕਰ ਲਈ ਹੈ ਮੇਰੀ ਖਪਤਕਾਰ ਆਈਡੀ ਜੀਰੋ ਇੱਕ ਨੌਂ ਦੋ ਸੱਤ ਤਿੰਨ ਚਾਰ ਪੰਜ ਪੰਜ ਹੈ ਮੈਂ ਹੁਣ ਨਵੇਂ ਸ਼ਹਿਰ ਜਾ ਚੁੱਕਿਆ ਹਾਂ ਜਿਸ ਦਾ ਐਡਰੈਸ ਮਕਾਨ ਨੰਬਰ ਛੱਬੀ ਸੈਕਟਰ ਸਤਾਈ ਏ ਚੰਡੀਗੜ੍ਹ ਹੈਗਾ ਹੈ ਮੈਨੂੰ ਗੈਸ ਸਲਿੰਡਰ ਦੀ ਜ਼ਰੂਰਤ ਹੈਗੀ ਹੈ ਇਸ ਲਈ ਮੇਰਾ ਐਡਰੈਸ ਅਪਡੇਟ ਕਰ ਦਿੱਤਾ ਜਾਵੇ